ਹਾਂਜੀ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਮੈਂ ਪੰਜਾਬ ਦੀ ਵਸਨੀਕ ਹਾਂ ਹਾਂਜੀ ਅਸੀਂ ਆਮ ਤੌਰ 'ਤੇ ਜੋ ਆਪਸ ਵਿੱਚ ਸ਼ਬਦ ਬੋਲਦੇ ਹਾਂ ਪੰਜਾਬੀ ਵਿੱਚ ਜਿਵੇਂ ਕਿ ਜੋ ਰੱਬ ਨੂੰ ਨਹੀਂ ਮੰਨਦਾ ਉਹਨੂੰ ਅਸੀਂ ਨਾਸਤਿਕ ਕਹਿੰਦੇ ਹਾਂ ਅਤੇ ਜਿਸ ਨੂੰ ਨਾ ਸੁਣਦਾ ਹੋਵੇ ਉਸਨੂੰ ਅਸੀਂ ਬੋਲਾ ਕਹਿੰਦੇ ਹਾਂ ਅਤੇ ਜਿਸ ਨੂੰ ਦਿਖਾਈ ਨਾ ਦਿੰਦਾ ਹੋਵੇ ਅਸੀਂ ਉਸਨੂੰ ਅੰਨਾ ਕਹਿੰਦੇ ਹਾਂ ਅਤੇ ਜਿਸ ਨਾਲ ਆਪ ਬੀਤੀ ਹੋਵੇ ਉਸਨੂੰ ਅਸੀਂ ਹੱਡ ਬੀਤੀ ਕਹਿੰਦੇ ਹਾਂ ਜਿਸ ਨੂੰ ਜਾਣਕਾਰੀ ਨਾ ਹੋਵੇ ਉਸਨੂੰ ਅਸੀਂ ਅਣਜਾਣ ਕਹਿੰਦੇ ਹਾਂ ਕਿਉਂਕਿ ਇਹ ਸਾਰੇ ਸ਼ਬਦ ਹਨ ਜਿਹੜੇ ਅਸੀਂ ਆਪਸ ਦੇ ਵਿੱਚ ਗੱਲ ਕਰਦੇ ਹਾਂ ਅਤੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਪੰਜਾਬ ਦੀ ਵਸਨੀਕ ਹਾਂ ਕਿਉਂਕਿ ਮੈਂ ਅਸੀਂ ਆਪਣੀ ਪੰਜਾਬੀ ਬੋਲੀ ਨੂੰ ਜ਼ਿਆਦਾਤਰ ਬੋਲਦੇ ਹਾਂ ਅਤੇ ਅਸੀਂ ਇਸ ਪੰਜਾਬੀ ਬੋਲੀ ਨੂੰ ਬਹੁਤ ਉਚਾਈ 'ਤੇ ਲੈ ਕੇ ਜਾਣਾ ਚਾਹੁੰਦੇ ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਅਸੀਂ ਇਸ ਪੰਜਾਬੀ ਬੋਲੀ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਵਸਨੀਕ ਹਾਂ ਪੰਜਾਬ 'ਚ ਰਹਿਣ ਵਾਲੇ ਹਾਂ ਪੰਜਾਬੀ ਬੋਲਦੇ ਹਾਂ ਅਤੇ ਸਾਡੀ ਮਨਪਸੰਦ ਭਾਸ਼ਾ ਵੀ ਪੰਜਾਬੀ ਹੈ